ਹਰੇਕ ਵਿਅਕਤੀ ਦੇ ਆਪਣੇ ਅਲੱਗ ਅਲੱਗ ਸ਼ੌਕ ਹੁੰਦੇ ਹਨ ਅਤੇ ਮੈਨੂੰ ਪੁਰਾਣੇ ਸਟੈਂਪਾਂ ਸਿੱਕੇ ਅਤੇ ਚੱਟਾਨਾਂ ਆਦਿ ਕੇ ਟੁਕੜੇ ਇਕੱਠੇ ਕਰਨ ਦਾ ਬਹੁਤ ਸ਼ੌਕ ਹੈ ਅੱਜ ਮੇਰੇ ਕੋਲ ਇਹਨਾਂ ਦੀ ਬਹੁਤ ਵੱਡੀ ਮਾਤਰਾ ਮੌਜੂਦ ਹੈ ਇਸ ਪੁਰਾਣੇ ਸਿੱਕਿਆਂ ਦੀ ਗੱਲ ਕਰੀਏ ਤਾਂ ਪੁਰਾਣੇ ਸਿੱਕਿਆਂ ਦਾ ਇਕੱਠਾ ਕਰਨ ਨਾਲ ਮੈਨੂੰ ਇਤਿਹਾਸ ਬਾਰੇ ਬਹੁਤ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਤੋਂ ਪਤਾ ਹੁੰਦਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਲੋਕਾਂ ਕੋਲ ਕਿਹੋ ਜਿਹੇ ਸਿੱਕੇ ਮੌਜੂਦ ਸਨ ਉਹਨਾਂ ਦੇ ਉੱਤੇ ਕਿਹੋ ਜਿਹੇ ਚਿੱਤਰ ਮੌਜੂਦ ਸਨ ਅਤੇ ਉਹਨਾਂ ਦੀ ਕੀ ਕੀਮਤ ਸੀ ਅਤੇ ਅੱਜ ਦੇ ਸਿੱਕਿਆਂ ਨਾਲੋਂ ਉਹ ਕਿਵੇਂ ਵੱਖ ਹਨ ਇਸ ਤੋਂ ਇਲਾਵਾ ਮੈਨੂੰ ਬਹੁਤ ਸਾਰੀਆਂ ਸਟੈਂਪਾਂ ਇਕੱਠੀਆਂ ਕਰਨ ਦਾ ਵੀ ਬਹੁਤ ਸ਼ੌਕ ਹੈ ਜਿਸ ਨਾਲ ਜਿਸ ਨਾਲ ਜੋ ਕਿ ਬਹੁਤ ਭਿੰਨ ਭਿੰਨ ਪ੍ਰਕਾਰ ਦੀਆਂ ਹਨ ਉਹਨਾਂ 'ਤੇ ਕਲ ਉਹਨਾਂ ਦਾ ਕਲਰ ਡਿਜ਼ਾਈਨ ਆਦਿ ਬਾਰੇ ਮੈਨੂੰ ਬਹੁਤ ਹੀ ਗਿਆਨ ਪ੍ਰਾਪਤ ਹੋਇਆ ਹੈ ਅਤੇ ਅੱਜ ਜੋ ਲੋਕ ਪੁਰਾਣੀਏ ਪੁਰਾਣੇ ਸਿੱਕੇ ਅਤੇ ਸਟੈਂਪਾਂ ਇਕੱਠੀਆਂ ਕਰਨ ਦੇ ਸ਼ੌਕੀਨ ਹੁੰਦੇ ਹਨ ਉਹ ਇਹਨਾਂ ਦੀ ਬਹੁਤ ਹੀ ਵੱਧ ਚੜ੍ਹ ਕੇ ਕੀਮਤ ਲਗਾਉਂਦੇ ਹਨ